ਮੇਨੇ ਆਪਣੇ ਸਕੂਲ ਵਿੱਚ ਫੰਕਸਨ ਵਿੱਚ ਹਿੱਸਾ ਲਿਆ ਸੀ ਫਿਰ ਮੈਨੇ ਡਾਂਸ ਕੀਤਾ ਡਾਂਸ ਸੀ ਸਾਰਿਆਂ ਨੂੰ ਵਧੀਆ ਲੱਗਿਆ ਸਾਰੇ ਟੀਚਰ ਹੀ ਖੁਸ਼ ਹੋ ਗਏ ਅਤੇ ਮੇਰੀ ਸਹੇਲੀਆਂ ਨੇ ਵੀ ਡਾਂਸ ਵਿਚ ਹਿੱਸਾ ਲਿਤਾ ਸੀ ਡਾਂਸ ਸਾਰਿਆਂ ਨੂੰ ਬਹੁਤ ਹੀ ਪਸੰਦ ਆਇਆ ਅਤੇ ਸਾਰੇ ਟੀਚਰਾਂ ਨੇ ਸਾਨੂੰ ਇੱਕ ਗਿਫਟ ਦਿੱਤਾ ਅਤੇ ਜਿੰਨੇ ਵੀ ਟੀਚਰ ਬੈਠੇ ਸਨ ਉਹ ਕਹਿੰਦੇ ਸਨ ਬਹੁਤ ਹੀ ਸੋਹਣਾ ਡਾਂਸ ਕਰਦੀ ਹੈ ਕਿੱਥੋਂ ਸਿੱਖ ਕੇ ਆਈ ਸੀ ਮੈਂ ਕਿਹਾ ਡਾਂਸ ਮੈਨੂੰ ਪਹਿਲਾਂ ਤੋਂ ਹੀ ਸਿੱਖੀ ਹੋਈ ਸੀ ਡਾਂਸ ਮੇਰਾ ਫੇਵਰਟ ਸੌਂਗ ਹੈ ਮੈਨੂੰ ਬਹੁਤ ਵਧੀਆ ਲੱਗਦਾ ਹੈ ਡਾਂਸ ਕਰਨਾ ਅਤੇ ਮੇਰੀ ਸਹੇਲੀਆਂ ਨੂੰ ਵੀ ਅਸੀਂ ਯਾਦਗਾਰ ਸਕੂਲ ਵਿੱਚ ਅੱਜ ਵੀ ਯਾਦ ਆਉਂਦੀ ਹੈ ਸਕੂਲ ਦੀਆਂ ਸਾਡੀ ਸਹੇਲੀਆਂ ਨੇ ਡਾਂਸ ਕੀਤਾ ਸੀ ਯਾਦਗਾਰ ਹਮੇਸ਼ਾ ਹੀ ਰਹੇਗਾ